ਵਿਗਿਆਨ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਹੀ ਆਸਾਨ ਅਤੇ ਸੁਖਾਲਾ ਬਣਾ ਦਿੱਤਾ ਹੈ ਪਹਿਲੇ ਦੇ ਜ਼ਮਾਨੇ ਵਿੱਚ ਲੋਕ ਗਰਮੀ ਤੋਂ ਬਚਣ ਲਈ ਹੱਥ ਦੇ ਨਾਲ਼ ਪੱਖੇ ਝੱਲ ਝੱਲਦੇ ਸਨ ਅਤੇ ਹੁਣ ਅੱਜ ਵਿਗਿਆਨਿਕ ਯੁੱਗ ਵਿੱਚ ਪੱਖੇ ਆ ਗਏ ਹਨ ਕੂਲਰ ਏਸੀ ਆ ਗਏ ਹਨ ਜਿਨ੍ਹਾਂ ਨੇ ਕਿ ਇਨਸਾਨ ਦੀ ਜ਼ਿੰਦਗੀ ਨੂੰ ਬਹੁਤ ਹੀ ਅਸ ਆਸਾਨ ਬਣਾ ਦਿੱਤਾ ਹੈ ਪਹਿਲਾਂ ਦੇ ਲੋਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਣ ਲਈ ਪੈਦਲ ਜਾਂਦੇ ਸੀ ਅਤੇ ਉਹਨਾਂ ਨੂੰ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਸੀ ਪਰ ਹੁਣ ਅੱਜ ਸਕੂਟਰ ਮੋਟਰਸਾਈਕਲ ਕਾਰ ਬੱਸ ਜਿਸਦੇ ਨਾਲ਼ ਕਿ ਕਿੰਨੀ ਹੀ ਦੂਰੀ ਨੂੰ ਕੁਝ ਘੰਟਿਆਂ ਵਿੱਚ ਹੀ ਤੈਅ ਕੀਤਾ ਜਾ ਸਕਦਾ ਹੈ ਪਹਿਲਾਂ ਲੋਕ ਚੁੱਲ੍ਹਿਆਂ 'ਤੇ ਅੱਗ ਬਾਲ਼ ਕੇ ਖਾਣਾ ਬਣਾਉਂਦੇ ਸੀ ਅੱਜ ਵਿਗਿਆਨਿਕ ਯੁੱਗ ਵਿੱਚ ਲੋਕ ਮਿੰਟਾਂ ਵਿੱਚ ਹੀ ਗੈਸ 'ਤੇ ਖਾਣਾ ਬਣਾ ਕੇ ਤਿਆਰ ਕਰ ਲੈਂਦੇ ਹਨ ਪਹਿਲਾਂ ਸਾਨੂੰ ਕਿਸੇ ਵੀ ਸਮਾਚਾਰ ਲਈ ਜਾਂ ਕਿਸੇ ਲਈ ਕਿਸੇ ਨੂੰ ਸੰਦੇਸ਼ ਪਹੁੰਚਾਉਣ ਲਈ ਚਿੱਠੀਆਂ ਪੱਤਰਾਂ ਦਾ ਯੂਜ਼ ਕਰਨਾ ਪੈਂਦਾ ਸੀ ਜਿਸਦੇ ਨਾਲ਼ ਕਿੰਨੇ ਕਿੰਨੇ ਦਿਨ ਮਤਲਬ ਇੱਕ ਖ਼ਬਰ ਕਿਸੇ ਤੱਕ ਪਹੁੰਚਾਉਣ ਨੂੰ ਕਿੰਨੇ ਦਿਨ ਹੀ ਲੱਗ ਜਾਂਦੇ ਸਨ ਹੁਣ ਅੱਜ ਵਿਗਿਆਨ ਦੇ ਇਸ ਟਾਈਮ ਵਿੱਚ ਫ਼ੋਨਾਂ ਦੇ ਰ ਰਾਹੀਂ ਇੰਟਰਨੈੱਟ ਦੇ ਰਾਹੀਂ ਅਸੀਂ ਮਿੰਟਾਂ ਵਿੱਚ ਆਪਣੀ ਗੱਲ ਦੂਸਰੇ ਤੱਕ ਪਹੁੰਚਾ ਸਕਦੇ ਹਾਂ